ਚੋਣਾਂ ਦੌਰਾਨ ਮੇਰਾ ਚੌਣ ਬੂਥ ਇੱਕ ਛੋਟੇ ਜਿਹੇ ਸਰਕਾਰੀ ਸਕੂਲ ਵਿੱਚ ਬਣਿਆ ਸੀ ਜਿਸਦਾ ਖੇਤਰਫਲ ਬਹੁਤ ਹੀ ਛੋਟਾ ਸੀ ਅਤੇ ਉੱਥੇ ਪਾਉਣ ਵਾਲੇ ਵੋਟਰ ਬਹੁਤ ਸਾਰੇ ਸਨ ਜਿਸ ਕਰਕੇ ਮੈਨੂੰ ਦੋ ਤਿੰਨ ਘੰਟੇ ਭੀੜ ਦਾ ਸਾਹਮਣਾ ਕਰਨਾ ਪਿਆ